ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਐਕਚੁਅਲ 'ਚ ਮੈਨੂੰ ਤੁਹਾਡਾ ਨੰਬਰ ਮਿਲਿਆ ਸੀ ਅਤੇ ਮੈਂ ਪੁੱਛਣਾ ਸੀਗਾ ਰੀਗਾਰਡਿੰਗ ਮਤਲਬ ਸਾਡੇ ਈਵੈਂਟਸ ਨੇ ਕਾਫ਼ੀ ਈਵੈਂਟਸ ਨੇ ਵੈਡਿੰਗ ਈਵੈਂਟ ਹੋ ਗਿਆ ਹਲਦੀ ਦਾ ਈਵੈਂਟ ਹੋ ਗਿਆ ਮਤਲਬ ਉਹਦੇ ਰੀਲੇਟਿਡ ਸਾਡੀ ਡੈਕੋਰੇਸ਼ਨ ਬਾਰੇ ਪੁੱਛਣਾ ਸੀ ਅਤੇ ਉਹਦੇ ਚਾਰਜਿਸ ਕੀ ਕੀ ਨੇ ਉਹਦੇ ਬਾਰੇ ਪੁੱਛਣਾ ਸੀ ਡੇਟਸ ਮੈਮ ਉਹਦੀਆਂ ਹੈਗੀਆਂ ਜਨਵਰੀ ਦੀਆਂ ਫੋਰਟੀਨ ਜਨਵਰੀ ਫੋਰਟੀਨ ਜਨਵਰੀ ਟੂ ਥਾਊਸੈਂਡ ਟਵੱਟੀ ਫੌਰ ਫੋਰਟੀਨ ਤੋਂ ਸਾਡੇ ਫੰਕਸ਼ਨਜ਼ ਸਟਾਰਟ ਹੋਣੇ ਆ ਹਲਦੀ ਹੈ ਫੋਰਟੀਨ ਦੀ ਹਲਦੀ ਹੋ ਗਈ ਫਿਫਟੀਨ ਦੀ ਹੋ ਗਈ ਆਪਣੀ ਸੈਰੇਮਨੀ ਹੋ ਗਈ ਜਿਹੜੀ ਆਪਣੀ ਲੇਡੀਸ ਸੰਗੀਤ ਹੋ ਗਏ ਅਤੇ ਸਿਕਸਟੀਨ ਦੀ ਮੈਰਿਜ ਹੋ ਗਈ ਸੈਵਨਟੀਨ ਰੀਸੈਪਸ਼ਨ ਹਾਂਜੀ ਹਮ ਪਟਿਆਲਾ ਅਰਬਨ ਸਟੇਟ ਓਕੇ ਲਾਈਵ ਲਾਈਵ ਲਾਈਵ ਫ੍ਰੈਸ਼ ਨਹੀਂ ਮੈਮ ਨਹੀਂ ਨਹੀਂ ਹਾਂਜੀ ਠੀਕ ਹੈ ਮੈਮ ਠੀਕ ਹੈ ਮੈਮ ਥੈਂਕ ਯੂ ਸੋ ਮੱਚ ਓਕੇ ਓਕੇ